ਇੱਕ ਵਧੀਆ ਡਾਂਸਰ ਤੋਂ ਇਲਾਵਾ ਡਾਂਸਰ ਦੀ ਲੁੱਕ ਬਹੁਤ ਵਧੀਆ ਸੋਹਣੀ ਲੱਗਣੀ ਚਾਹੀ ਸੋਹਣੀ ਹੋਣੀ ਚਾਹੀਦੀ ਹੈ ਜਦੋਂ ਸਟੇਜ 'ਤੇ ਡਾਂਸ ਕਰਦਾ ਹੈ ਤਾਂ ਉਸਦੀ ਪ੍ਰਮੋ ਪ੍ਰਫੋਰਮੈਂਸ ਵਧੀਆ ਹੋਣੀ ਚਾਹੀਦੀ ਹੈ ਤਾਂ ਜੋ ਦੇਖਣ ਵਾਲਿਆਂ ਦਾ ਇੰਟਰਟੇਨਮੈਂਟ ਵਧੀਆ ਤਰੀਕੇ ਨਾਲ ਹੋ ਸਕੇ ਅਤੇ ਪ੍ਰਫੋਮੈਂਸ ਦੇਖਣ ਵਾਲੇ ਖੁਸ਼ ਹੋ ਸਕਣ ਦੇਖ ਕੇ ਡਾਂਸ ਡਾਂਸਰ ਦਾ ਪਹਿਰਾਵਾ ਬਹੁਤ ਵਧੀਆ ਹੋਣਾ ਚਾਹੀਦਾ ਹੈ ਅਤੇ ਜੋ ਸਾਰੇ ਪਰਿਵਾਰ ਵਿੱਚ ਬੈਠ ਕੇ ਦੇਖਿਆ ਜਾ ਸਕੇ ਡਾਂਸਰ ਦੇ ਚਿਹਰੇ 'ਤੇ ਸਮਾਈਲ ਹੋਣੀ ਚਾਹੀਦੀ ਹੈ ਅਤੇ ਮੇਕਅੱਪ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਣਾ ਚਾਹੀਦਾ ਹੈ ਮੇਕਅੱਪ ਜ਼ਿਆਦਾ ਓਵਰ ਨਹੀਂ ਕੀਤਾ ਹੋਣਾ ਚਾਹੀਦਾ ਤਾਂ ਵਾ ਵਧੀਆ ਨਹੀਂ ਲੱਗਦੇ ਜਦੋ ਕਿਸੇ ਮੈਰਿਜ਼ 'ਤੇ ਜਾਂਦੇ ਹਾਂ ਪੰਜਾਬੀ ਪਹਿਰਾਵੇ ਵਾਲੇ ਡਾਂਸਰਾਂ ਨੂੰ ਹੀ ਬੁੱਕ ਕਰਨਾ ਚਾਹੀਦਾ ਹੈ ਜੋ ਸਾਰੇ ਤਾਂ ਜੋ ਸਾਰੇ ਪਰਿਵਾਰ ਵਿੱਚ ਬੈਠ ਕੇ ਦੇਖਿਆ ਜਾ ਸਕੇ ਮੈਰਿਜ਼ਾਂ ਦੇ ਵਿੱਚ ਮੈਰਿਜ਼ਾਂ ਵਿੱਚ ਡਾਂਸਰਾਂ ਨੂੰ ਇਸ ਕਰਕੇ ਬੁੱਕ ਕੀਤਾ ਜਾਂਦਾ ਹੈ ਤਾਂ ਜੋ ਖੁਸ਼ੀ ਦਾ ਮਾਹੌਲ ਬਣ ਸਕੇ ਇਹ ਡਾਂਸਰਾਂ ਵਿੱਚ ਕੁਦਰਤੀ ਕਲਾ ਅਤੇ ਐਕਟ ਹੁੰਦਾ ਹੈ ਜੋ ਸਾਰਿਆਂ ਦੇ ਸਾਹਮਣੇ ਪੇਸ਼ ਕਰਦੇ ਹਨ